ਮੈਂ ਟਮਾਟੋ ਵਿੱਚ ਦੋ ਪੀਜ਼ੇ ਓਡਰ ਕਰਵਾਏ ਨੇ ਫੈਮਲੀ ਵਿੱਚ ਘੱਟ ਹੋ ਗਏ ਇਸ ਕਰਕੇ ਮੈਨੂੰ ਦੋ ਬਰਗਰ ਪੀਜਾ ਕੋਲਡ੍ਰਿੰਕ ਮੰਗਵਾਉਣੀ ਹੈ ਇਸ ਲਈ ਮੇਰੇ ਓਡਰ ਦਿੱਤਾ ਜਾਵੇ ਓਡਰ ਵਾਲਾ ਵੀ ਬਹੁਤ ਹੀ ਵਧੀਆ ਹੈ ਪੰਜ ਮਿੰਟਾਂ 'ਤੇ ਹੀ ਓਡਰ ਆ ਜਾਂਦਾ ਹੈ ਅਸੀਂ ਉਸ ਦੀਆਂ ਚੀਜ਼ਾਂ ਬਹੁਤ ਗਰਮ ਹੁੰਦੀਆਂ ਹਨ ਅਤੇ ਸੁਆਦਿਸ਼ਟ ਹੁੰਦੀਆਂ ਨੇ ਮੈਨੂੰ ਬਹੁਤ ਹੀ ਅਨੰਦ ਆਉਂਦਾ ਖਾਣ ਵਿੱਚ ਅਤੇ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਹੀ ਮਜ਼ਾ ਆਉਂਦਾ ਹੈ ਸਾਰਾ ਪਰਿਵਾਰ ਓਡਰ ਉਸ ਤੋਂ ਹੀ ਮੰਗਵਾਉਂਦੇ ਹਨ ਕਿਉਂਕਿ ਉਹ ਛੇਤੀ ਆਉਂਦਾ ਹੈ ਅਰੇ ਹੋਰ ਕਿਸੀ ਤੋਂ ਮੰਗਵਾਈਏ ਤਾਂ ਉਹ ਟੈਮ ਲਗਾ ਦਿੰਦਾ ਹੈ ਅਤੇ ਬਹੁਤ ਦੇਰ ਵਿੱਚ ਆਉਂਦਾ ਹੈ ਇਹ ਸਾਡਾ ਡਰੈਵਰੀ ਵਾਲਾ ਬਹੁਤ ਹੀ ਜਲਦੀ ਆ ਜਾਂਦਾ ਹੈ ਅਸੀਂ ਗਰਮ ਹੀ ਚੀਜ਼ਾਂ ਮੰਗਵਾਉਂਦੇ ਹਾਂ